ਗਿਆਰ੍ਹਾਂ ਅਕਤੂਬਰ ਉੱਨੀ ਸੌ ਬਹੱਤਰ ਤੇਰ੍ਹਾਂ ਨਵੰਬਰ ਉੱਨੀ ਸੌ ਉਣਹੱਤਰ ਨੌਂ ਸਤੰਬਰ ਦੋ ਹਜ਼ਾਰ ਇੱਕ ਚਾਰ ਅਕਤੂਬਰ ਦੋ ਹਜ਼ਾਰ ਅੱਠ ਪੰਜ ਮਈ ਦੋ ਹਜ਼ਾਰ ਗਿਆਰ੍ਹਾਂ